ਆਪਾਂ ਜਿਵੇਂ ਕੱਪੜੇ ਧੋਂਦੇ ਹਾਂ ਕੱਪੜੇ ਧੋਣ ਦੇ ਅਲੱ ਅਲੱਗ ਅਲੱਗ ਤਰੀਕੇ ਹੁੰਦੇ ਨੇ ਜਿਵੇਂ ਕਿ ਆਪਾਂ ਹੱਥ ਨਾਲ ਵੀ ਕੱਪੜੇ ਧੋ ਸਕਦੇ ਹਾਂ ਅੱਜ ਕੱਲ੍ਹ ਤਾਂ ਅਸੀਂ ਮਸ਼ੀਨਾਂ ਦੀ ਵਰਤੋਂ ਨਾਲ ਜਿਹੜੇ ਕੱਪੜੇ ਆ ਜ਼ਿਆਦਾਤਰ ਧੋਂਦੇ ਹਾਂ ਪੁਰਾਣੇ ਸਮੇਂ 'ਚ ਤਾਂ ਹੱਥ ਨਾਲ ਹੀ ਧ ਧੋਏ ਜਾਂਦੇ ਸੀਗੇ ਕੱਪੜੇ ਜੇ ਤਾਂ ਕੱਪੜੇ ਜ਼ਿਆਦਾ ਗੰਦੇ ਹੁੰਦੇ ਸੀ ਤਾਂ ਥਾਪੀ ਦੀ ਮਦਦ ਨਾਲ ਉਹਨਾਂ ਨੂੰ ਕੁੱਟ ਕੇ ਨਿਖਾੜਿਆ ਜਾਂਦਾ ਸੀ ਅਤੇ ਜੇ ਘੱਟ ਗੰਦੇ ਹੁੰਦੇ ਸੀ ਤਾਂ ਆਪਾਂ ਉਹਨੂੰ ਉਹਨਾਂ ਨੂੰ ਹੱਥਾਂ ਨਾਲ ਹੀ ਮਲ ਕੇ ਜਿਹੜਾ ਆ ਸਾਫ ਕਰ ਲੈਂਦੇ ਹੁੰਦੇ ਸੀ ਅਤੇ ਸਾਬਣ ਦੀ ਵਰਤੋਂ ਨਾਲ ਉਹਨਾਂ ਨੂੰ ਧੋ ਲਿਆ ਜਾਂਦਾ ਸੀ ਜਾਂ ਸਰਫ ਹੁੰਦੀ ਸੀ ਅਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਤਾਂ ਅਸੀਂ ਮਸ਼ੀਨਾਂ ਦੇ ਵਿੱਚ ਪਾਣੀ ਪਾ ਕੇ ਸਰਫ ਪਾ ਕੇ ਅਤੇ ਵਿੱਚ ਗੇੜੇ ਦੇਣ ਬਸ ਕੱਪੜੇ ਸੁੱਟ ਦਿੰਦੇ ਹਾਂ ਅਤੇ ਜਦੋਂ ਉਹ ਸਾਫ ਹੋ ਜਾਂਦੇ ਆ ਅਤੇ ਮਸ਼ੀਨ ਵੱਲੋਂ ਸਾਨੂੰ ਆਵਾਜ਼ ਆ ਜਾਂਦੀ ਹੈ ਅਤੇ ਅਸੀਂ ਉਹਨਾਂ ਨੂੰ ਬਾਹਰ ਕੱਢ ਲੈਂਦੇ ਹਾਂ ਅਤੇ ਫਿਰ ਸੁਕਾਉਣ ਨੂੰ ਵੀ ਮਸ਼ੀਨ ਦੇ ਵਿੱਚ ਹੀ ਇੱਕ ਸਿਸਟਮ ਹੁੰਦਾ ਏ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਕੱਪੜਿਆਂ ਨੂੰ ਪਾ ਦਿੰਦੇ ਹਾਂ ਅਤੇ ਸੁੱਕ ਵੀ ਜਾਂਦੇ ਨੇ ਥੋੜ੍ਹੇ ਥੋੜ੍ਹੇ ਹਲਕੇ ਹਲਕੇ ਗਿੱਲੇ ਹੁੰਦੇ ਨੇ ਅਤੇ ਅਸੀਂ ਫਿਰ ਜੇ ਤਾਂ ਧੁੱਪ ਲੱਗੀ ਹੋਵੇ ਤਾਂ ਧੁੱਪ 'ਚ ਪਾ ਦਿੰਦੇ ਹਾਂ ਗਰਮੀਆਂ ਦੇ ਸਮੇਂ 'ਚ ਅਤੇ ਜਿਵੇਂ ਸਰਦੀਆਂ 'ਚ ਧੁੱਪ ਬਹੁਤ ਘੱਟ ਹੁੰਦੀ ਆ ਅਤੇ ਫਿਰ ਅਸੀਂ ਅੰਦਰ ਜਿਹੜਾ ਹੈ ਸਟੈਂਡ ਖੜ੍ਹਾ ਕਰਕੇ ਉਹਦੇ 'ਤੇ ਉਹ ਪਾ ਦਈ ਦੇ ਆ ਕਿ ਜਿਹੜਾ ਹਵਾ ਮਾੜੀ ਮੋਟੀ ਹਵਾ ਚੱਲਦੀ ਆ ਉਹਦੇ ਤਾਂ ਉਹ ਸੁੱਕ ਜਾਂਦੇ ਨੇ ਅਤੇ ਜਦੋਂ ਪੁਰਾਣੇ ਸਮੇਂ 'ਚ ਤਾਂ ਸੁਕਾਉਣ ਨੂੰ ਵੀ ਕੋਈ ਚੀਜ਼ ਨਹੀਂ ਸੀ ਹੁੰਦੀ ਫਿਰ ਅਸੀਂ ਧੁੱਪ ਦੀ ਸਹਾਇਤਾ ਨਾਲ ਹੀ ਸਕਾਉਂਦੇ ਹੁੰਦੇ ਸੀ ਅਤੇ ਜਦੋਂ ਸਰਦੀਆਂ ਹੁੰਦੀਆਂ ਸੀ ਜਾਂ ਮੀਂਹ ਕਣੀ ਹੁੰਦੀ ਸੀ ਫਿਰ ਅੰਦਰ ਉਹਨਾਂ ਨੂੰ ਪਾ ਦੇਣਾ ਪੱਖੇ ਥੱਲੇ ਪਾ ਦਿੰਦੇ ਸੀ ਅਤੇ ਜਿਹਦੇ ਨਾਲ ਉਹ ਸੁੱਕ ਜਾਂਦੇ ਹੁੰਦੇ ਸੀ